ਮੈਨੂੰ ਕੱਪੜੇ ਸੀਨਾ ਅਤੇ ਉਸਨੂੰ ਡਿਜ਼ਾਈਨ ਵੱਖ ਵੱਖ ਤਰ੍ਹਾਂ ਦੇ ਵਿੱਚ ਡਿਜ਼ਾਇਨ ਕਰਨਾ ਬਹੁਤ ਪਸੰਦ ਹੈ ਮੈਨੂੰ ਕਢਾਈ ਸਲਾਈ ਅਤੇ ਬੁਨਾਈ ਕਰਨਾ ਬਹੁਤ ਚੰਗਾ ਲੱਗਦਾ ਹੈ ਮੇਰੀ ਇੱਕ ਬਹੁਤ ਵੱਡੀ ਬੁਟੀਕ ਹੈ ਜਿਸ ਵਿੱਚ ਮੈਂ ਕਈ ਤਰ੍ਹਾਂ ਦੇ ਲੇਡੀਜ ਸੂਟ ਕੱਪੜੇ ਡਰੈਸ ਅਤੇ ਸੀਨੀ ਹਾ ਕੁਝ ਗਰਾਕ ਤਾਂ ਮੈਨੂੰ ਆਪਣੀਆਂ ਡਰੈਸਾਂ ਮੇਰੇ ਉੱਤੇ ਹੀ ਛੱਡ ਜਾਂਦੇ ਹਨ ਕਿ ਤੁਸੀਂ ਆਪਣੇ ਤਰੀਕੇ ਨਾਲ ਉਸ ਨੂੰ ਸੀ ਕੇ ਸਾਨੂੰ ਦੇ ਦਿਓ ਪਰ ਮੈਂ ਉਹਨਾਂ ਦਾ ਪ੍ਰੋਪਰ ਨਾਪ ਹਾਈਟ ਹਰ ਚੀਜ਼ ਉਹਨਾਂ ਦੀ ਲੰਬਾਈ ਉਚਾਈ ਸਾਰਾ ਕੁਝ ਰੰਗ ਰੂਪ ਦੇਖ ਕੇ ਉਸਨੂੰ ਕੱਪੜਾ ਡਿਜ਼ਾਇਨ ਕਰਕੇ ਦੇਨੀ ਹਾਂ ਮੈਨੂੰ ਕੱਪੜੇ ਸੀਨਾ ਬਹੁਤ ਚੰਗਾ ਲੱਗਦਾ ਹੈ ਮੈਂ ਉਸਨੂੰ ਚੰਗੀ ਤਰ੍ਹਾਂ ਕਟਿੰਗ ਕਰਕੇ ਉਸ ਨੂੰ ਸੀ ਕੇ ਕਸਟਮਰ ਨੂੰ ਟਰਾਈ ਕਰਵਾ ਕੇ ਫਿਰ ਉਹਨਾਂ ਤੋਂ ਪੈਸਿਆਂ ਦੀ ਮੰਗ ਕਰਦੀ ਹਾਂ ਕੁਝ ਡਿਜ਼ਾਇਨ ਖੁਦ ਦੇ ਕੇ ਜਾਂਦੇ ਹਨ ਤੇ ਕੁਝ ਕਸਟਮਰ ਮੈਨੂੰ ਕਹਿੰਦੇ ਹਨ ਕਿ ਤੁਸੀਂ ਆਪਣੇ ਹਿਸਾਬ ਨਾਲ ਉਸ ਨੂੰ ਸੀਕੇ ਸਾਨੂੰ ਦੇ ਦਿਓ ਮੈਂ ਕਸਟਮਰ ਦੀ ਗ੍ਰਾਹਕਾਂ ਦੀ ਹਾਈਟ ਗ੍ਰਾਹਕਾਂ ਦੀ ਲੰਬਾਈ ਉਚਾਈ ਦੇ ਹਿਸਾਬ ਨਾਲ ਉਹਨਾਂ ਦੇ ਕੱਪੜੇ ਸੀਨੀ ਹਾਂ ਮੈਨੂੰ ਕੱਪੜੇ ਸੀਨਾ ਬਹੁਤ ਚੰਗਾ ਲੱਗਦਾ ਹੈ ਮੈਂ ਆਪਣੇ ਕਿਤਾਬਾਂ ਵਿੱਚ ਵੀ ਕਾਫੀ ਡਿਜ਼ਾਇਨ ਕਾਫੀ ਹੱਦ ਤੱਕ ਚੀਜ਼ਾਂ ਸਿੱਖੀਆਂ ਹਨ ਤੇ ਮੈਨੂੰ ਮੇਰਾ ਬਰਾਂਡ ਜਾਂ ਆਨਲਾਈਨ ਕੁਛ ਵੀ ਮਨ ਪਸੰਦੀ ਹਰਪ੍ਰੀਤ ਜੀ ਤੇ ਉਨਾਂ ਦੇ ਹਰਪ੍ਰੀਤ ਕੌਰ ਅਤੇ